ਹਾਂਜੀ ਸਰ ਜੈਨ ਹੋਟਲ ਤੋਂ ਬੋਲ ਰਹੇ ਹੋ ਤੁਸੀ ਮੈਂ ਪਰਦੀਪ ਸਿੰਘ ਬੋਲ ਰਿਹਾ ਰੋਪੜ ਤੋਂ ਅਤੇ ਸ਼ਾਮ ਨੂੰ ਨਾ ਇੱਕ ਪਾਰਟੀ ਰ ਹੈਗੀ ਸੀਗੀ ਅਤੇ ਉਹਦੇ ਵਾਸਤੇ ਇੱਕ ਟੇਬਲ ਬੁੱਕ ਕਰਨਾ ਸੀਗਾ ਅਤੇ ਬਰਡੇ ਪਾਰਟੀ ਹੈ ਉਹ ਅਤੇ ਅਸੀਂ ਫੈਮਲੀ ਮੈਂਬਰ ਆ ਰਹੇ ਹਾਂ ਸਾਰੇ ਤੁਹਾਡੇ ਕੋਲ ਟੇਬਲ 'ਤੇ ਰੀਜ਼ਰਵੇਸ਼ਨ 'ਤੇ ਕੋਈ ਪੇਸ਼ਕਸ ਹੈ ਕੋਈ ਔਫਰ ਦੇ ਰਹੇ ਹੋ ਤੁਸੀਂ ਕਿਉਂਕਿ ਹੁਣ ਤਿਉਹਾਰਾਂ ਦੇ ਦਿਨ ਵੀ ਚੱਲ ਰਹੇ ਹੈ ਜੇ ਤੁਹਾਡੇ ਕੋਈ ਪੇਸ਼ਕਸ਼ ਹੈ ਜਾਂ ਔਫਰ ਹੈ ਤਾਂ ਜ਼ਰੂਰ ਦੱਸੋ